ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇਨਸਾਨ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ 'ਤੇ ਪਹਿਲਾਂ ਮੈਂ ਆਪਣੇ ਬਾਰੇ ਗ ਦੱਸਣਾ ਚਾਹੁੰਦੀ ਹਾਂ ਕਿ ਮੇਰੀਆਂ ਕੀ ਸ਼ਕਤੀਆਂ ਨੇ ਅਤੇ ਕੀ ਕਮਜ਼ੋਰੀਆਂ ਸ਼ਕਤੀਆਂ ਜਾਣੀ ਕਿ ਸਟਰੈਂਥ ਸਟਰੈਂਥ ਆਪਣੀ ਇਹ ਆ ਕਿ ਆਪਾਂ ਹਰੇਕ ਦੀ ਹੈਲਪ ਕਰਨੀ ਚਾਹੀਦੀ ਆ ਸਾਨੂੰ ਮਨ ਨੂੰ ਸਕੂਨ ਮਿਲਦਾ ਜਦੋਂ ਵੀ ਕਿਸੇ ਦੀ ਹੈਲਪ ਕਰਦੇ ਹਾਂ ਜਿਵੇਂ ਸਵੇਰ ਨੂੰ ਕੰਮ 'ਤੇ ਨਿਕਲੀ ਦਾ ਅਤੇ ਘਰ ਦੇ ਕੋਲ ਕੋਈ ਬਜ਼ੁਰਗ ਹੋਵੇ ਕੋਈ ਬੱਚਾ ਹੋਵੇ ਹਾਂਜੀ ਕਿਸੇ ਨੂੰ ਹੈਲਪ ਦੀ ਲੋੜ ਹੋਵੇ ਅਤੇ ਆਪਾਂ ਦਿਲੋਂ ਉਹਨਾਂ ਦੀ ਹੈਲਪ ਕਰੀਦੀ ਆ ਸਟਰੈਂਥ ਕਹਿ ਲਉ ਬੰਦੇ ਨੂੰ ਮਨ ਨੂੰ ਸਕੂਨ ਮਿਲਣਾ ਚਾਹੀਦਾ ਕਿ ਹਾਂ ਮੈਂ ਕਿਸੇ ਦੀ ਹੈਲਪ ਕੀਤੀ ਹੈ ਅਤੇ ਮਨ ਨੂੰ ਬਹੁਤ ਸਕੂਨ ਮਿਲਿਆ ਅਤੇ ਕਮਜ਼ੋਰੀਆਂ ਕਮਜ਼ੋਰੀਆਂ ਇਹ ਨੇ ਕਿ ਹਾਂਜੀ ਕਿਸੇ ਚੀਜ਼ ਵਿੱਚ ਮਨ ਲਗਾ ਕੇ ਜੇ ਆਪਾਂ ਕੰਮ ਕਰਨ ਲੱਗ ਜਾਈਏ ਤਾਂ ਸਾਨੂੰ ਬਾਹਰ ਦੀ ਦੁਨੀਆਂ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਹਾਂਜੀ ਧੰਨਵਾਦ